ਹਾਂਜੀ ਭਾਅ ਜੀ ਫਲਿਪਕਾਰਟ ਤੋਂ ਗੱਲ ਕਰਦੇ ਪਏ ਹੋ ਹਾਂਜੀ ਭਾਅ ਜੀ ਮੈਂ ਨਾ ਤੁਹਾਡੇ ਕੋਲੋਂ ਫੋਨ ਲਿੱਤਾ ਸੀਗਾ ਇੱਕ ਗਲੈਕਸੀ ਐੱਸ ਟਵੈਂਟੀ ਵੰਨ ਐਫ ਈ ਨਾਮ ਤੋਂ ਸੈਮਸੰਗ ਦਾ ਵੰਸ਼ ਦੇ ਨਾਮ ਤੋਂ ਅਤੇ ਮੈਨੂੰ ਨਾ ਪ੍ਰੋਡਕਟ ਬਹੁਤ ਹੀ ਜ਼ਿਆਦਾ ਪਸੰਦ ਆਇਆ ਅਤੇ ਮੈਂ ਕਿਹਾ ਲਿਖ ਕੀ ਰਿਵਿਊ ਪਾਉਣਾ ਅਤੇ ਉੱਦਾਂ ਫਾਈਵ ਸਟਾਰ ਰੇਟਿੰਗ ਦੇ ਦਿੱਤੀ ਹੋਈ ਹੈ ਮੈਂ ਪਰ ਮੈਂ ਕਿਹਾ ਗੱਲ ਕਰ ਕੇ ਰਿਵਿਊ ਦੇ ਦਿੰਦਾ ਨਾ ਮਾੜਾ ਜਿਹਾ ਅਤੇ ਮੈਨੂੰ ਪ੍ਰੋਡਕਟ ਬਹੁਤ ਹੀ ਪਸੰਦ ਆਇਆ ਜੀ ਇਹਦੀ ਬੈਟਰੀ ਲਾਈਫ ਵਗੈਰਾ ਇੰਨੀ ਵਧੀਆ ਹੈਗੀ ਕਿ ਮੈਂ ਸਾਰਾ ਲਗਭਗ ਸਾਰਾ ਦਿਨ ਚਲਾਉਂਦਾ ਵਾਂ ਫੋਨ 'ਤੇ ਮੈਂ ਬਸ ਰਾਤ 'ਚ ਇੱਕ ਵਾਰੀ ਚਾਰਜ 'ਤੇ ਲਾਉਂਦਾ ਹਾਂ ਉਹ ਵੀ ਮਤਲਬ ਅੱਧੇ ਦੋ ਇੱਕ ਘੰਟੇ ਤੱਕ ਮਾੜਾ ਜਿਹਾ ਸਾਰਾ ਫੁੱਲ ਚਾਰਜ ਹੋ ਜਾਂਦਾ ਵਾ ਅਤੇ ਉਸ ਤੋਂ ਬਾਅਦ ਸਾਰਾ ਸਾਰਾ ਦਾ ਸਾਰਾ ਦਿਨ ਚੱਲਦਾ ਵਾ ਅਤੇ ਬੈਟਰੀ ਲਾਈਫ ਇੰਨੀ ਵਧੀਆ ਵਾ ਨਿਕਲੀ ਕੁਆਲਿਟੀ ਵਗੈਰਾ ਇੰਨੀ ਵਧੀਆ ਚਲਦੀ ਆ ਕਾਲਿੰਗ ਵਗੈਰਾ ਕੁਆਲਿਟੀ ਤਾਂ ਇੰਨੀ ਵਧੀਆ ਹੈਗੀ ਆਰਾਮ ਨਾਲ ਸਾਰਿਆਂ ਨੂੰ ਪਤਾ ਚੱਲ ਜਾਂਦਾ ਮੈਂ ਕੀ ਕਹਿੰਦਾ ਪਿਆ ਅਤੇ ਕੀ ਹੁੰਦਾ ਪਿਆ ਮੇਰੇ ਆਸ ਪਾਸ ਦੀਆਂ ਗੱਲਾਂ ਵੀ ਲੋਕਾਂ ਨੂੰ ਪਤਾ ਚੱਲ ਜਾਂਦੀਆਂ ਨੋਰਮਲੀ ਆਰਾਮ ਨਾਲ ਆਸੇ ਪਾਸੇ ਦਾ ਕੋਈ ਸ਼ੋਰ ਨਹੀਂ ਆਉਂਦਾ ਕਿੱਧਰੋਂ ਵੀ ਕੋਈ ਕਿਸੇ ਨੂੰ ਪਤਾ ਨਹੀਂ ਚੱਲਦਾ ਕਿ ਆਸ ਪਾਸ ਕੀ ਹੈਗਾ ਸਿਰਫ ਮੇਰੀ ਇਕੱਲੀ ਆਵਾਜ਼ ਆਉਂਦੀ ਆਰਾਮ ਨਾਲ ਅਤੇ ਨਾ ਇਹਦੀ ਇਹਦੀ ਸਕਰੀਨ ਇੰਨੀ ਵਧੀਆ ਹੈ ਕਿ ਮੇਰੇ ਖਿਆਲ 'ਤੇ ਮੇਰੇ ਖਿਆਲ ਤੋਂ ਇੱਕ ਤੋਂ ਵੀਹ ਇੱਕ ਸੌ ਵੀਹ ਵ ਹਰਟ ਦੀ ਸਕਰੀਨ ਹੈਗੀ ਅਤੇ ਇੰਨੀ ਮੱਖਣ ਵਰਗੀ ਚਲਦੀ ਹੈ ਨਾ ਵਿੱਚ ਬਿਲਕੁਲ ਨਹੀਂ ਰੁਕਦੀ ਅਤੇ ਇੰਨੀ ਵਧੀਆ ਕੁਆਲਿਟੀ ਦਿੰਦੀ ਹੈ ਉਤੋਂ ਕੈਮਰਾ ਦੀ ਤਾਂ ਤਰੀਫਾਂ ਹੀ ਖ਼ਤਮ ਨਹੀਂ ਹੁੰਦੀਆਂ ਮੈਂ ਮੇਰੀ ਫੈਮਿਲੀ ਫੈਮਿਲੀ ਅਤੇ ਰਿਲੇਟਿਵਸ ਵਗੈਰਾ ਸਾਰੇ ਸਪੈਸ਼ਲੀ ਮੈਨੂੰ ਬੁਲਾਉਂਦੇ ਆ ਤਾਂ ਕਿ ਮੈਂ ਉਹਨਾਂ ਦੀ ਆ ਕੇ ਆਪਣੇ ਫੋਨ 'ਤੇ ਫੋਟੋਆਂ ਖਿੱਚਾਂ ਇੰਨੀ ਵਧੀਆ ਫੋਟੋ ਆਉਂਦੀਆਂ ਇੰਨੀਆਂ ਵਧੀਆ ਕਲਰ ਵਗੈਰਾ ਆਉਂਦੇ ਸਾਰਾ ਕੁਛ ਇੰਨਾ ਵਧੀਆ ਆਉਂਦਾ ਵਾ ਥੈਂਕ ਯੂ ਸੋ ਮੱਚ ਭਾਅ ਜੀ